ਮੈਂ ਆਪਣੇ ਜੀਵਨ ਦੇ ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਵਾਹਿਗੁਰੂ ਦਾ ਨਾਮ ਲੈ ਕੇ ਕਰਦੀ ਹਾਂ ਮੇਰੇ ਪਿਤਾ ਜੀ ਮੈਨੂੰ ਹਮੇਸ਼ਾਂ ਸਮਝਾਉਂਦੇ ਹਨ ਕਿ ਸਾਨੂੰ ਆਪਣੇ ਜੀਵਨ ਵਿੱਚ ਕਿਸੇ ਵੀ ਸ਼ੁੱਭ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਜਾਂ ਕੋਈ ਵੀ ਅਸੀਂ ਆਪਣੀ ਕਾ ਜੀਵਨ ਵਿੱਚ ਸ਼ੁੱਭ ਕੰਮ ਕਰਨ ਜਾ ਰਹੇ ਹਾਂ ਤਾਂ ਉਸ ਤੋਂ ਪਹਿਲਾਂ ਵਾਹਿਗੁਰੂ ਦਾ ਨਾਮ ਲੈਣਾ ਜ਼ਰੂਰ ਚਾਹੀਦਾ ਹੈ ਇੱਕ ਵਾਰ ਵਾਹਿਗੁਰੂ ਅੱਗੇ ਅਰਦਾਸ ਕਰਨੀ ਚਾਹੀਦੀ ਹੈ ਤਾਂ ਜੋ ਵਾਹਿਗੁਰੂ ਸਾਡੇ ਅੰਗ ਸੰਗ ਸਹਾਏ ਹੋਣ ਅਤੇ ਸਾਨੂੰ ਹਰ ਵੇਲੇ ਹ ਸਹਾਇਤਾ ਕਰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਸਾਨੂੰ ਇਸ ਦੀ ਸਿੱਖਿਆ ਦਿੱਤੀ ਜਾਂਦੀ ਹੈ ਕਿ ਸਾਨੂੰ ਹਰ ਇੱਕ ਕੰਮ ਦੀ ਸ਼ੁਰੂਆਤ ਵਾਹਿਗੁਰੂ ਦੇ ਨਾਮ ਤੋਂ ਕਰਨੀ ਚਾਹੀਦੀ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਪੰਕਤੀ ਆਉਂਦੀ ਹੈ ਸੰਤਾ ਕੇ ਕਾਰਜ ਆਪ ਖਲੋਆ ਹਰਿ ਕੰਮ ਕਰਾਵਨ ਆਇਆ ਰਾਮ ਇਸ ਦਾ ਅਰਥ ਹੈ ਕਿ ਅਗਰ ਕੋਈ ਵੀ ਵਿਅਕਤੀ ਆਪਣੇ ਕਿਸੇ ਵੀ ਕੰਮ ਦੀ ਸ਼ੁਰੂਆਤ ਵਾਹਿਗੁਰੂ ਦਾ ਨਾਮ ਲੈ ਕੇ ਕਰਦਾ ਹੈ ਤਾਂ ਉੱਥੇ ਵਾਹਿਗੁਰੂ ਉਸ ਦੇ ਕੰਮ ਵਿੱਚ ਆਪ ਸਹਾਈ ਹੁੰਦੇ ਹਨ ਅਤੇ ਉਸਦੇ ਆਪ ਆਪ ਸਿਰੇ ਚਾੜਦੇ ਹਨ ਇਸ ਵਾਹਿਗੁਰੂ ਦਾ ਨਾਮ ਲੈ ਕੇ ਕੀਤਾ ਕੋਈ ਵੀ ਕੰਮ ਅਧੂਰਾ ਨਹੀਂ ਰਹਿੰਦਾ ਅਤੇ ਇਹ ਸੰਪੂਰਨ ਹੁੰਦਾ ਹੈ ਅਤੇ ਨਿਰਵਿਘਨ ਸੰਪੂਰਨ ਹੁੰਦਾ ਹੈ ਇਸ ਦੇ ਨਾਲ ਕਿਸੇ ਵੀ ਕੰਮ ਵਿੱਚ ਰੁਕਾਵਟ ਨਹੀਂ ਆਉਂਦੀ ਅਤੇ ਸਾਡੇ ਸਾਰੇ ਕੰਮ ਚੰਗੀ ਵਧੀਆ ਤਰ੍ਹਾਂ ਨੇਪਰੇ ਚੜ੍ਹਦੇ ਹਨ ਜਿਸ ਨਾਲ ਵਿਅਕਤੀ ਆਪਣੀ ਇੱਕ ਚੰਗਾ ਜੀਵਨ ਜੀਂਦਾ ਹੈ ਅਤੇ ਵਾਹਿਗੁਰੂ ਦੇ ਨਾਲ ਜੁੜਿਆ ਰਹਿੰਦਾ ਹੈ